ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਪਹਿਲੇ ਇਹ ਦੱਸੋ ਕੀ ਤੁਹਾਡਾ ਜਿਹੜਾ ਈਵੈਂਟ ਹੈ ਉਹਦੀ ਡੇਟਸ ਕੀ ਨੇ ਜਨਵਰੀ ਹਾਂਜੀ ਫੋਰਟੀਨ 'ਤੇ ਹੋਰ ਨਹੀਂ ਫੋਰਟੀਨ ਜਨਵਰੀ ਨੂੰ ਕੀ ਹੈ ਮਤਲਬ ਤੁਹਾਡਾ ਹਲਦੀ ਹੈ ਜਾਂ ਲੇਡੀਸ ਸੰਗੀਤ ਫੋਰਟੀਨ ਤੋਂ ਸਟਾਰਟ ਹੈ ਫੋਰਟੀਨ ਅੱਗੇ ਫੀਫਟੀਨ ਸਿਕਸਟੀਨ ਕਦੋਂ ਤੱਕ ਚਲਨੇ ਨੇ ਹਾਂਜੀ ਓਕੇ ਠੀਕ ਹੈ ਜੀ ਠੀਕ ਹੈ ਓਕੇ ਜੀ ਆਪਣੇ ਵੱਲੋਂ ਚਾਰ ਦਿਨ ਫੰਕਸ਼ਨ ਚੱਲਨੇ ਹੈ ਠੀਕ ਹੈ ਮੈਮ ਤੁਸੀਂ ਇਹ ਜਿਹੜੇ ਮੇਰੇ ਤੋਂ ਮਤਲਬ ਜਿਹੜੇ ਅਸੀਂ ਪਲੇਨ ਕਰਦੇ ਆ ਇੱਕ ਤਾਂ ਹੁੰਦੀ ਹੈ ਸਿਰਫ਼ ਡੈਕਰੋਸ਼ਨ ਦਾ ਪੈਕਿਜ ਹੈ ਕੱਲਾ ਜੇ ਤੁਸੀਂ ਨਾਲ਼ ਮਤਲਬ ਸਵੀਟ ਜਾਂ ਕੈਟਰਿੰਗ ਵੀ ਨਾਲ਼ ਕਰਵਾਉਣਾ ਚਾਹੁੰਦੇ ਓ ਉਹ ਵੀ ਹੋ ਜਾਏਗਾ ਮਤਲਬ ਡਿਫ਼ਰੈਟ ਡਿਫ਼ਰੈਟ ਪੈਕਿਜਿਸ ਹੈ ਹਨਾਂ ਤੁਸੀਂ ਕੀ ਕੀ ਇਨਕਲੀਊਡ ਕਰਨਾ ਚਾਹੁੰਦੇ ਓ ਇਹ ਤੁਹਾਡੀ ਲੌਕੇਸ਼ਨ ਵੀ ਇੱਕ ਵਾਰੀ ਸ਼ੇਅਰ ਕਰਦੋ ਲੌਕੇਸ਼ਨ ਕਿੱਥੇ ਹੈ ਮਤਲਬ ਕਿਹੜੀ ਜਗ੍ਹਾ 'ਤੇ ਤੁਸੀਂ ਤੁਹਾਡਾ ਫੰਕਸ਼ਨ ਹੈ ਅੱਛਾ ਪਟਿਆਲਾ ਅਰਬਨ ਸਟੇਟ ਦੇ ਵਿੱਚ ਹੈ ਠੀਕ ਹੈ ਮੈਮ ਇਹ ਸਾਡੇ ਕੋਲ ਨਾ ਡਿਫ਼ਰੈਟ ਡਿਫ਼ਰੈਟ ਪੈਕਿਜਿਸ ਹੈ ਕਈ ਵਾਰੀ ਕੱਲਾ ਹਲਦੀ ਦਾ ਕਰਵਾਂਦੇ ਹੈ ਜਾਂ ਬੈਂਗਲ ਸੈਰੇਮਨੀ ਹੋ ਗਈ ਜਾਂ ਰਿੰਗ ਲੇਡੀਸ ਸੰਗੀਤ ਹੋ ਗਿਆ ਹਨਾਂ ਅਤੇ ਕਈ ਵਾਰੀ ਪੂਰਾ ਈ ਪੈਕਿਜ ਅਸੀਂ ਦੇ ਦਿੰਦੇ ਆ ਵੀ ਆਹ ਸਾਰੇ ਜਿੰਨੇ ਵੀ ਤੁਹਾਡੇ ਈਵੈਂਟਸ ਹੈ ਉਹ ਸਾਰੇ ਹੀ ਮਤਲਬ ਇੰਨਕਲੀਊਡਿਡ ਹੋਣਗੇ ਉਹਦੇ ਵਿੱਚ ਅਤੇ ਮੈਂ ਡਿਫ਼ਰੈਟ ਹਾਂਜੀ ਤੁਹਾਨੂੰ ਇਹ ਦੱਸੋ ਮੈਮ ਤੁਸੀਂ ਤੁਹਾਨੂੰ ਜਿਹੜਾ ਫਲਾਵਰਸ ਹੈ ਉਹ ਤੁਹਾਨੂੰ ਆਰਟੀਫਿਸ਼ਲ ਵੀ ਚੱਲਣਗੇ ਜਾਂ ਲਾਈਵ ਫਲਾਵਰ ਹੀ ਮਤਲਵ ਚਾਹੀਦੇ ਫ੍ਰੈਸ਼ ਫਲਾਵਰ ਅੱਛਾ ਫ੍ਰੈਸ਼ ਫੁਲਾਵਰ ਮੈਮ ਫ੍ਰੈਸ਼ ਫਲਾਵਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਥੋੜੀ ਜਿਹੀ ਕੋਸਟ ਜਿਹੜੀ ਹੈ ਉਹ ਵੱਧ ਜਾਂਦੀ ਆ ਫ੍ਰੈਸ਼ ਫਲਾਵਰਸ ਦੇ ਵਿੱਚ ਕਿਉਂਕਿ ਸਾਨੂੰ ਡੇਲੀ ਦੇ ਡੇਲੀ ਉਹ ਨਵੇਂ ਹੀ ਮੰਗਵਾਉਣੇ ਪੈਂਦੇ ਹੈ ਅਤੇ ਉਹਦੇ ਕਰਕੇ ਥੋੜ੍ਹੀ ਥੋਡੀ ਕੋਸਟ ਥੋੜ੍ਹਾ ਬਜਟ ਮਤਲਬ ਚਲਿਆ ਜਾਏਗਾ ਤੁਹਾਡਾ ਬਜਟ ਦੀ ਕੋਈ ਤੁਹਾਨੂੰ ਦਿੱਕਤ ਤਾਂ ਨੀ ਹੈਗੀ ਮੈਮ ਚਲੋ ਠੀਕ ਹੈ ਮੈਮ ਫਿਰ ਮੈਂ ਨਾ ਤੁਹਾਨੂੰ ਇਹ ਤੁਹਾਡਾ ਵੱਅਟਸਅੱਪ ਨੰਬਰ ਹੈ ਮੈਮ ਹਾਂਜੀ ਮੈਂ ਤੁਹਾਨੂੰ ਇਹ ਵੱਅਟਸਅੱਪ ਨੰਬਰ ਦੇ ਉੱਤੇ ਹੀ ਤੁਹਾਨੂੰ ਆਪਣੇ ਜਿੰਨੇ ਵੀ ਪੈਕਜਿਸ ਹੈ ਉਹਨਾਂ ਦੀ ਸਾਰੀ ਡੀਟੇਲ ਸ਼ੇਅਰ ਕਰ ਦਿੰਦੀ ਹਾਂ ਅਤੇ ਨਾਲ਼ ਹੀ ਮੈਮ ਤੁਹਾਨੂੰ ਮੈਂ ਕੁੱਛ ਪਿਕਚਰਸ ਵੀ ਸ਼ੇਅਰ ਕਰਾਂਗੀ ਤੁਸੀਂ ਉਹ ਦੇਖ ਸਕਦੇ ਜੇ ਤੁਸੀਂ ਪਹਿਲਾਂ ਕਿਸ ਤਰ੍ਹਾਂ ਦੀ ਜਿਹੜੇ ਫੰਕਸ਼ਨਸ ਹੈ ਕਿਵੇਂ ਦੇ ਅਸੀਂ ਔਰਗਨਾਇਸ ਕੀਤੇ ਆ ਪਹਿਲਾਂ ਵੀ ਠੀਕ ਆ ਮੈਮ ਓਕੇ ਥੈਂਕਯੂ ਸੋ ਮੱਚ ਮੈਮ ਓਕੇ ਜੀ ਓਕੇ